ਹੈਲੋ ਸਿਮਰਨਜੀਤ ਕੋ ਸਿਮਰਨਜੀਤ ਕੌਰ ਜੀ ਗੱਲ ਕਰ ਰਹੇ ਹੋ ਮੇਰਾ ਨਾਮ ਜਸਵਿੰਦਰ ਸਿੰਘ ਆ ਮੈਂ ਤੁਹਾਡਾ ਨੰਬਰ ਅਨੀਤਾ ਰਾਣੀ ਜੀ ਕੋਲ ਲਿਆ ਸੀ ਓ ਹਾਂਜੀ ਹਾਂਜੀ ਤੁਹਾਡੇ ਗੁਆਂਢ ਦੇ ਚੀ ਰਹਿੰਦੇ ਆ ਤੇ ਉਹਨਾਂ ਤੇ ਨੰਬਰ ਤੁਹਾਡਾ ਲਿਆ ਸੀ ਤੇ ਮੈਂ ਨਵਾਂ ਨਵਾਂ ਕਪੂਰਥਲੇ ਵਿੱਚ ਆਇਆ ਸੀ ਤੇ ਮੈਂ ਤਾ ਐਕਚੁਲੀ ਇੱਥੇ ਨਵਾਂ ਨਵਾਂ ਕਿੱਦਾਂ ਆਇਆ ਵਾ ਤੇ ਸਬਜੀ ਮਾਰਕਿਟ ਦਾ ਮੈਨੂੰ ਨਹੀਂ ਐ ਤੇ ਮੈਂ ਮਤਲਬ ਸਬਜ਼ੀਆਂ ਜਿਹੜੀਆਂ ਫਰੈਸ਼ ਲੈਣਾ ਚਾਹੁੰਦਾ ਵਾਂ ਤੇ ਉਹਨਾਂ ਨੇ ਮੈਨੂੰ ਤੁਹਾਡਾ ਨੰਬਰ ਦਿੱਤਾ ਸੀ ਤੁਹਾਡਾ ਹਵਾਲਾ ਦਿੱਤਾ ਸੀ ਕਹਿੰਦੇ ਤੁਸੀਂ ਸਿਮਰਨਜੀਤ ਕੌਰ ਜੀ ਨਾਲ ਗੱਲ ਕਰਿਓ ਉਹ ਉਹਾਨੂੰ ਸਹੀ ਗਾਈਡ ਕਰਨਗੇ ਕਿੱਥੋਂ ਫਰੈੱਸ਼ ਸਬਜੀ ਮਿਲਦੀ ਹੈ ਮੈਂ ਕਪੂਰਥਲੇ ਦੇ ਅਜੇ ਆਹ ਦੋ ਦਿਨ ਪਹਿਲਾਂ ਹੀ ਇੱਥੇ ਆਇਆ ਵਾਂ ਮੈਂ ਹਾਂਜੀ ਪਲੀਜ ਇੱਕ ਵਾਰੀ ਦੁਬਾਰਾ ਬੋਲੀਓ ਕਿਹੜਾ ਚੋਂਕ ਸੁਬਾਸ਼ ਚੰਦਰ ਚੌਂਕ

ਠੀਕ ਹੈ ਮੈਡਮ ਇਹ ਸ਼ੁਭਾਸ਼ ਚੰਦਰ ਚੌਂਕ ਦੇ ਕੋਲ ਸਬਜ਼ੀ ਮੰਡੀ ਹੈ ਉੱਥੇ ਸਾਨੂੰ ਸਸਤੇ ਰੇਟ ਤੇ ਵੀ ਮਿਲ ਜੂਗੀ ਕੁਛ ਮਹਿੰਗੀ ਤੇ ਨਹੀਂ ਹੁੰਦੀ ਹਾਂਜੀ ਹਾਂ ਤਿੰਨ ਚਾਰ ਦਿਨ ਦੀ ਸਬਜੀ ਮੈਂ ਲੈਦਾ ਹੁੰਦਾ ਵਾ ਤਿੰਨ ਚਾਰ ਦਿਨਾਂ ਬਾਅਦ ਫਿਰ ਮਤਲਬ ਜਾਨਾ ਹੁੰਨਾ ਮੈਂ ਠੀਕ ਹ ਮੈਡਮ ਮੈਂ ਸੁਭਾਸ਼ ਚੰਦਰ ਚੌਂਕ ਦੇ ਲਾਗੇ ਸਬਜੀ ਮੰਡੀ ਆ ਤੇ ਮੈਡਮ ਜੇ ਕੋਈ ਸਾਧਨ ਜਿਹੜਾ ਵਾ ਕਿਹੜਾ ਵਧੀਆ ਰਹੂਗਾ ਕਿ ਮੈਂ ਆਟੋ ਤੇ ਜਾਵਾਂ ਕਿ ਜਾਂ ਮੈਂ ਮੇਰੇ ਕੋਲ ਕਾਰ ਵੀ ਹੈਗੀ ਆ ਜਾਂ ਕਾਰ ਦੇ ਵਿੱਚ ਜਾਵਾਂ ਜਾਂ ਮੈਂ ਮੋਟਰ ਆਟੋ ਕਰ ਲਿਓ ਤੇ ਆਟੋ ਵਾਲੇ ਮੈਡਮ ਕਿਹੜਾ ਮਤਲਬ ਆਟੋ ਵਾਲੇ ਪੈਸੇ ਬਹੁਤ ਮੰਗਦੇ ਨੇ ਤੇ ਮੋਟਰਸਾਈਕਲ ਤੇ ਹਾਂਜੀ ਇਹ ਮਤਲਬ ਜਿੱਦਾਂ ਮੈਂ ਤੁਹਾਡੇ ਗਵਾਂਢ ਹੀ ਰਹਿੰਦਾ ਵਾਂ ਤੇ ਆਪਾਂ ਨੂੰ ਇਥੋਂ ਕਿੰਨੇ ਕ ਕਿਲੋਮੀਟਰ ਪਵੇਗਾ ਸਬਜੀ ਜਿਹੜੀ ਮੰਡੀ ਐ ਦੋ ਤਿੰਨ ਕਿਲੋਮੀਟਰ ਹੈ ਤੇ ਚਲੋ ਠੀਕ ਹੈ ਤੇ ਕੋਈ ਕਿਸੇ ਵੀ ਟਾਈਮ ਆਪਾਂ ਜਾ ਸਕਦੇ ਸਬਜੀ ਮੰਡੀ ਕਿ ਜਾਂ ਕੋਈ ਟਾਈਮ ਜਿਹੜਾ ਫਿਕਸ ਹੈਗਾ ਵਾ ਹਾਂਜੀ ਠੀਕ ਹੈ ਜੀ ਚਲੋ ਠੀਕ ਹੈ ਮੈਡਮ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਸਾਰਾ ਕੁਝ ਸਮਝਾਇਆ ਵਾ ਤੇ ਮੈਂ ਆਟੋ ਰਿਕਸ਼ਾ ਹਾਂਜੀ ਹਾਂਜੀ ਠੀਕ ਹੈ ਜੀ ਮੈਡਮ ਧੰਨਵਾਦ ਜੀ ਬਹੁਤ ਬਹੁਤ